ਵਿਕਾਸਸ਼ੀਲ ਸੰਸਾਰ ਬਾਰੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਕੱਲ੍ਹ ਤਰੱਕੀ ਜੋ ਹੈ ਜਦੋਂ ਦਾ ਮੋਬਾਈਲ ਸ਼ੁਰੂ ਹੋਇਆ ਹੈ ਉਸ ਤੋਂ ਬਾਅਦ ਤਰੱਕੀ ਦੀ ਜੋ ਗਤੀ ਹੈ ਬਹੁਤ ਤੇਜ਼ ਹੋ ਗਈ ਉਸ ਤੋਂ ਪਹਿਲਾਂ ਤਗ ਤਰੱਕੀ ਤਾਂ ਹੋਈ ਵਿਕਾਸ ਤਾਂ ਹੋਇਆ ਲੇਕਿਨ ਉਹਦੀ ਜਿਹੜੀ ਗਤੀ ਦੀ ਸੀਮਾ ਸੀ ਉਹ ਬਹੁਤ ਘੱਟ ਸੀ ਲੇਕਿਨ ਬੜੀ ਫਾਸਟ ਜੋ ਡਿਬਲਪਮੈਂਟ ਹੋਈ ਹੈ ਵਿਕਾਸ ਹੋਇਆ ਉਹ ਮੋਬਾਈਲ ਦੇ ਆਉਣ ਤੋਂ ਬਾਅਦ ਹੋਇਆ ਅਤੇ ਜਿਹੜੀਆਂ ਗੱਲਾਂ ਅਸੀਂ ਦੇਖ ਰਹੇ ਹਾਂ ਅਸੀਂ ਪੜ੍ਹਿਆ ਕਰਦੇ ਸੀ ਹੁਣ ਜਿਵੇਂ ਕਿ ਅਸੀਂ ਕਹਿ ਦਿੰਦੇ ਹਾਂ ਲਉ ਜੀ ਲਾਈਵ ਹੋਜੋ ਲਾਈਵ ਹੋ ਗਏ ਉਹ ਅਸੀਂ ਜਦ ਅਸੀਂ ਪੜ੍ਹਦੇ ਸੀ ਮਹਾਭਾਰਤ ਦੀ ਯੁੱਧ ਦਾ ਵਰਣਨ ਧ੍ਰਿਤਰਾਸ਼ਟਰ ਜੋ ਜੀ ਅੱਖਾਂ ਤੋਂ ਨਹੀਂ ਦੇਖ ਸਕਦੇ ਸੀ ਉਹਨਾਂ ਦੇ ਸੰਜੇ ਨੇ ਉਹਨਾਂ ਨੂੰ ਯੁੱਧ ਦਾ ਉੱਥੇ ਬੈਠੇ ਹੀ ਸਾਰਾ ਹਾਲ ਸੁਣਾਉਂਦੇ ਰਹੇ ਤਾਂ ਹੁਣ ਪਤਾ ਲੱਗਦਾ ਕਿ ਪਹਿਲੇ ਜ਼ਮਾਨੇ 'ਚ ਵੀ ਇਹ ਸਾਇੰਸ ਤਰੱਕੀ ਪਰ ਸੀ ਹੁਣ ਤਾਂ ਗੋਲੀ ਮਾਰ ਦਿਉ ਤਾਂ ਬੰਦਾ ਗੋਲੀ ਮਾਰ ਤਾਂ ਦਿੰਦਾ ਵਾਪਸ ਨਹੀਂ ਕਰ ਸਕਦਾ ਲੇਕਿਨ ਪਹਿਲਾਂ ਤਾਂ ਅਜਿਹੇ ਜਿਹੇ ਤੀਰ ਕਮਾਨ ਬਣੇ ਹੋਏ ਸੀ ਕਿ ਜੋ ਪਹਿਲਾਂ ਛੱਡਦੇ ਸੀ ਅਤੇ ਉਹਨਾਂ ਨੂੰ ਵਾਪਸ ਵੀ ਬੁਲਾ ਲੈਂਦੇ ਸੀ ਅਜੇ ਸਾਇੰਸ ਤਰੱਕੀ ਤਾਂ ਬਹੁਤ ਕਰ ਗਈ ਹੈ ਪਰ ਜੋ ਸਾਨੂੰ ਲੱਗਦਾ ਤਾ ਵੀ ਇਹ ਗੱਪਾਂ ਹੈ ਉਹ ਬੰਦੇ ਨੂੰ ਯਾਦ ਕਰੋ ਸਾਹਮਣੇ ਆ ਗਿਆ ਇਹ ਸਾਰਾ ਇੱਕ ਲਾਈਵ ਟੈਲੀਕਾਸਟ ਹੀ ਹੁੰਦਾ ਸੀ ਅਤੇ ਹੁਣ ਲੱਗਦਾ ਸਾਡੀ ਦੁਨੀਆ ਜੋ ਪਹਿਲੀ ਸੀ ਸਾਡੀ ਪੁਰਾਣੀ ਸੱਭਿਅਤਾ ਉਹ ਵੀ ਬਹੁਤ ਵਿਕਾਸਸ਼ੀਲ ਸੀ ਲੇਕਿਨ ਵਿੱਚ ਨੂੰ ਸੱਭਿਅਤਾ ਦਾ ਜੋ ਹਰਾਸ਼ ਹੋਇਆ ਉਸ ਤੋਂ ਬਾਅਦ ਹੁਣ ਸੱਭਿਅਤਾ ਫਿਰ ਆਪਣੀ ਚਰਮਸੀਮਾ 'ਤੇ ਚਰਮੋਉਸ਼ਕਰਸ਼ 'ਤੇ ਪਹੁੰਚ ਰਹੀ ਹੈ